ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ ਹੈ ਸਾਰੇ ਸਾਨੂੰ ਅਸੀਂ ਜਾਣਦੇ ਹਾਂ ਤਾਂ ਉਸੇ ਤਰੀਕੇ ਦੇ ਨਾਲ਼ ਖੇਤੀਬਾੜੀ ਨੂੰ ਪੰਜਾਬ ਦੇ ਵਿੱਚ ਦੇਖਿਆ ਵੀ ਜਾਂਦਾ ਅਲੱਗ ਅਲੱਗ ਡਿਫਰੈਂਟ ਡਿਫਰੈਂਟਸ ਐਂਗਲਸ ਤੋਂ ਕੁਛ ਐਕਸਪਰਟਸ ਨੇ ਜਿਵੇਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਇਹਦਾ ਕਾਫ਼ੀ ਰੋਲ ਹੈ ਕਿ ਖੇਤੀਬਾੜੀ ਨੂੰ ਸੁਧਾਰਨਾ ਜਾਂ ਫਿਰ ਇਹ ਕ ਕਿਸਾਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਸੀਡ ਪ੍ਰੋਵਾਈਡ ਕਰਦੇ ਨੇ ਬੀਜ ਦਿੰਦੇ ਨੇ ਹਾਈਬ੍ਰਿਡ ਬੀਜ ਦਿੰਦੇ ਨੇ ਕਿਸਾਨ ਮੇਲੇ ਲੱਗਦੇ ਨੇ ਜਿੱਥੇ ਕਿਸਾਨ ਆਉਂਦੇ ਨੇ ਉਹਨਾਂ ਨੂੰ ਹਰ ਇੱਕ ਸੀਡ ਦੇ ਨਾਲ਼ ਰਿਲੇਟਿਡਸ ਜਾਂ ਕਿਸੇ ਫ਼ਸਲ ਦੇ ਨਾਲ਼ ਰਿਲੇਟਿਡ ਪੈਸਟੀਸਾਈਡ ਫਰਟੀਲਾਈਜ਼ਰਸ ਉਹਨਾਂ ਦੇ ਨਾਲ਼ ਰਿਲੇਟਿਡਸ ਇਨਫੋਰਮੇਸ਼ਨ ਦਿੰਦੇ ਰਹਿੰਦੇ ਨੇ ਪਿੰਡਾਂ 'ਚ ਜਾ ਕੇ ਵੀ ਐਕਸਪਰਟਸ ਕਿਸਾਨਾਂ ਦੇ ਨਾਲ਼ ਗੱਲਬਾਤ ਕਰਦੇ ਆ ਉਹਨਾਂ ਦੇ ਖੇਤਾਂ ਦੇ ਵਿੱਚ ਟਰਾਇਲ ਲਗਾਉਂਦੇ ਨੇ ਤਾਂ ਉਹ ਸਾਰਾ ਕੁਛ ਸਾਡੇ ਪਿੰਡ ਦੇ ਵਿੱਚ ਵੀ ਈਵਨ ਕਿ ਮੇਰੇ ਤਾਇਆ ਜੀ ਹੁਣੀ ਪੀ ਏ ਯੂ ਤੋਂ ਕਾਫ਼ੀ ਸੀਡਸ ਵਗੈਰਾ ਲੈ ਕੇ ਉਹ ਕੰਮ ਕਰਦੇ ਨੇ ਜਿਹਦੇ ਕਿ ਜਿਹੜੇ ਬਾਅਦ ਦੇ ਨਤੀਜੇ ਨੇ ਉਹ ਬਹੁਤ ਵਧੀਆ ਨਿਕਲਦੇ ਨੇ